ਸਰਕਾਰਾਂ ਆਪਣੇ ਨਾਗਰਿਕਾਂ ਦੇ ਲਈ ਬਹੁਤ ਸਾਰੀਆਂ ਸਿਹਤ ਸਬੰਧੀ ਸਹੂਲਤਾਂ ਲੈ ਕੇ ਆਉਂਦੀ ਹੈ ਜਿਹਦੇ ਵਿੱਚ ਅਸੀਂ ਅੱਜ ਅਸੀਂ ਗੱਲ ਕਰ ਸਕਦੇ ਹਾਂ ਸਿਹਤ ਬੀਮਾ ਯੋਜਨਾ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਬਾਰੇ ਗੱਲ ਕਰਾਂਗੇ ਜਿਹਦੇ ਵਿੱਚ ਹਰੇਕ ਨਾਗਰਿਕ ਨੂੰ ਪੰਜ ਲੱਖ ਤੱਕ ਦਾ ਜਿਹੜਾ ਬੀਮਾ ਹੁੰਦਾ ਉਹ ਫ੍ਰੀ ਹੁੰਦਾ ਹੈ ਕੋਈ ਵੀ ਨਾਗਰਿਕ ਆਪਣਾ ਇਲਾਜ ਕਰਵਾਉਣ ਦੇ ਲਈ ਕਰਵਾ ਸਕਦਾ ਹੈ ਕਿਸੇ ਵੀ ਹਸਪਤਾਲ ਵਿੱਚ ਜਾ ਕੇ ਉਹ ਆਪਣਾ ਇਲਾਜ ਕਰਵਾ ਸਕਦਾ ਹੈ ਉਸਨੂੰ ਪੰਜ ਲੱਖ ਤੱਕ ਦਾ ਜਿਹੜਾ ਕੋਈ ਵੀ ਬਿਮਾਰੀ ਹੈ ਉਹ ਉਸਦਾ ਟ੍ਰੀਟਮੈਂਟ ਉੱਥੇ ਕਰਵਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ ਜਨ ਔਸ਼ਧੀ ਜਨ ਔਸ਼ਧੀ ਸਕੀਮ ਜਿਹਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਸਸਤੇ ਰੇਟਾਂ ਦੇ ਉੱਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਗੀਆਂ ਹਰ ਇੱਕ ਨਾਗਰਿਕ ਦੀ ਪਹੁੰਚ ਨਹੀਂ ਹੁੰਦੀ ਕਿ ਉਹ ਮਹਿੰਗੀਆਂ ਦਵਾਈਆਂ ਖਰੀਦ ਸਕੇ ਇਸ ਲਈ ਸਰਕਾਰ ਨੇ ਇਹ ਸਕੀਮ ਲੈ ਕੇ ਆਂਦੀ ਹੈ ਜਿਹਦੇ ਵਿੱਚ ਸਸਤੇ ਰੇਟਾਂ ਦੇ ਉੱਤੇ ਲੋਕਾਂ ਨੂੰ ਨੂੰ ਦਵਾਈਆਂ ਜਿਹੜੀਆਂ ਸੀਗੀਆਂ ਉਹ ਦਵਾਈਆਂ ਨੂੰ ਲੋਕ ਲੋਕਾਂ ਤੱਕ ਪਹੁੰਚਾਉਣ ਦੇ ਲਈ ਸਸਤੇ ਰੇਟਾਂ ਦੇ ਉੱਤੇ ਦਵਾਈਆਂ ਲੈ ਕੇ ਆਏ ਇਸ ਤੋਂ ਇਲ ਇਸ ਤੋਂ ਇਲਾਵਾ ਔਰਤਾਂ ਦੇ ਲਈ ਬਹੁਤ ਸਾਰੀਆਂ ਸਿਹਤ ਸਬੰਧੀ ਸਹੂਲਤਾਂ ਦਿੱਤੀਆਂ ਗਈਆਂ ਜਿਹਦੇ ਵਿੱਚ ਜੱਚਾ ਬੱਚਾ ਦੀ ਸੁਰੱਖਿਆ ਦੇ ਲਈ ਹਰ ਹਰ ਮਹੀਨੇ ਔਰਤ ਨੂੰ ਹਜ਼ਾਰ ਰੁਪਈਆ ਦੇਣਾ ਅਤੇ ਉਸ ਤੋਂ ਇਲਾਵਾ ਡਲਿਵਰੀ ਸਮੇਂ ਬ ਡਲਿਵਰੀ ਸਮੇਂ ਇਸ ਦਾ ਧਿਆਨ ਰੱਖਣਾ ਅਤੇ ਉਸ ਤੋਂ ਇਲਾਵਾ ਉਸਨੂੰ ਡਲਿਵਰੀ ਤੋਂ ਬਾਅਦ ਹੋਣ ਵਾਲੇ ਲਾਭਾਂ ਬਾਰੇ ਦ ਦੱਸਣਾ ਅਤੇ ਉਸ ਤੋਂ ਬਾਅਦ ਉਸ ਨੂੰ ਡਲਿਵਰੀ ਤੋਂ ਬਾਅਦ ਚਾਰ ਜਾਂ ਪੰਜ ਹਜ਼ਾਰ ਰੁਪਏ ਦੇਣਾ ਇਹ ਸਾਰੀਆਂ ਚੀਜ਼ਾ ਸਰਕਾਰਾਂ ਦੁਆਰਾ ਚਲਾਈਆਂ ਜਾਂਦੀਆਂ ਨੇ ਗੀਆਂ ਬੱਚਿਆਂ ਦੀ ਸਿਹਤ ਸਬੰਧੀ ਸਹੂਲਤਾਂ ਇਹ ਨੀਗੀਆਂ ਵੀ ਬੱਚੇ ਦੀ ਜਿਹੜੀ ਵੈਕਸੀਨੇਸ਼ਨ ਹੁੰਦੀ ਹੈ ਉਹ ਫ੍ਰੀ ਹੁੰਦੀ ਹੈ ਸਰਕਾਰੀ ਹਸਤਾਲਾਂ ਦੇ ਵਿੱਚ ਹਰ ਇੱਕ ਬੱਚੇ ਨੂੰ ਜਿਹੜੇ ਉਸਦੇ ਵਿਕਾਸ ਦੇ ਲਈ ਟੀਕਾਕਰਨ ਜ਼ਰੂਰੀ ਹੁੰਦਾ ਉਹ ਸਹੀ ਤਰੀਕੇ ਦੇ ਨਾਲ ਚਲਾਇਆ ਜਾਂਦਾ ਹੈ ਜਿਹਦੇ ਨਾਲ ਬੱਚਾ ਤੰਦਰੁਸਤ ਰਹਿੰਦਾ ਹੈ ਇਸ ਤੋਂ ਇਸ ਤੋਂ ਇਲਾਵਾ ਬੱਚੇ ਨੂੰ ਨੂੰ ਖਾਣਾ ਦੇਣਾ ਬੱਚੇ ਨੂੰ ਐਲੀਮੈਂਟਰੀ ਤੱਕ ਸਿੱਖਿਆ ਦੇਣਾ ਅਤੇ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਆ ਜਾਂਦੀਆਂ ਹਨ ਇਸ ਤੋਂ ਇਲਾਵਾ ਬੱਚਿਆਂ ਦਾ ਧਿਆਨ ਰੱਖਣਾ ਇਹ ਸਾਰੀਆਂ ਗੱਲਾਂ ਸਰਕਾਰ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ